ਮੈਂ ਇੱਕ ਵਾਰ ਛੋਟੇ ਬੱਚੇ ਦਾ ਇੱਕ ਲੋਂਗ ਕੋਟ ਜੋ ਕਿ ਸਰਦੀਆਂ ਵਿੱਚ ਪਹਿਨਿਆ ਜਾਂਦਾ ਹੈ ਉਸਨੂੰ ਸਿਲਾਈ ਕੀਤਾ ਸੀ ਇਸ ਕੋਟ ਦੀ ਮੈਂ ਨਕਲ ਇੱਕ ਬਾਹਰੋਂ ਆਏ ਕੋਟ ਦੀ ਤਰ੍ਹਾਂ ਕੀਤੀ ਸੀ ਜੋ ਕਿ ਇੰਗਲੈਂਡ ਵਿੱਚੋਂ ਆਇਆ ਸੀ ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ ਬਾਹਰਲੇ ਕੱਪੜਿਆਂ ਦਾ ਕਾਫ਼ੀ ਕਰੇਜ ਹੈ ਸਾਡੇ ਪੰਜਾਬ ਦੇ ਵਿੱਚ ਅਤੇ ਉਹ ਬਹੁਤ ਹੀ ਸੋਹਣਾ ਸਿਲਾਈ ਕੀਤਾ ਹੋਇਆ ਸੀ ਅਤੇ ਮੈਨੂੰ ਲੱਗਿਆ ਕਿ ਮੈਂ ਇਸਨੂੰ ਨਕਲ ਕਰਕੇ ਸੇਮ ਇਸੇ ਤਰ੍ਹਾਂ ਦਾ ਹੀ ਸਿਲਾਈ ਕਰਾਂ ਅਤੇ ਮੈਂ ਉਸਦੇ ਲਈ ਕੱਪੜਾ ਖਰੀਦਿਆ ਜਿਵੇਂ ਜਿਵੇਂ ਉਸ ਵਿੱਚ ਲੱਗਾ ਹੋਇਆ ਸੀ ਇਨਰ ਐਂਡ ਆਊਟਰ ਬਟਨਸ ਵਗੈਰਾ ਸਭ ਕੁਛ ਖਰੀਦਿਆ ਅਤੇ ਮੈਂ ਚਾਹਿਆ ਕਿ ਇਹਨੂੰ ਸੇਮ ਉਸੇ ਤਰ੍ਹਾਂ ਹੀ ਮਤਲਬ ਸਿਲਾਈ ਕਰ ਸਕਾਂ ਅਤੇ ਮੈਂ ਦੋ ਤਿੰਨ ਦਿਨ ਮਤਲਬ ਓਹਦੇ ਨੂੰ ਨਕਲ ਕੀਤੀ ਅਤੇ ਮੈਂ ਸੇਮ ਮਤਲਬ ਉਸ ਤਰ੍ਹਾਂ ਦਾ ਸਿਲਾਈ ਕਰ ਸਕੀ ਅਤੇ ਇਸ ਵਿੱਚ ਉਸਦੀ ਸਾਰਿਆਂ ਨੇ ਪ੍ਰਸ਼ੰਸਾ ਕੀਤੀ ਕਿ ਹਾਂ ਤੁਸੀਂ ਮਤਲਬ ਅੰਡਰਗਰਾਊਂਡ ਸੇਮ ਸਿ ਸਿਲਾਈ ਕਰ ਲਿਆ ਹੈ ਅਤੇ ਬੱਚੇ ਨੂੰ ਵੀ ਮੈਂ ਪਹਿਨਾ ਕੇ ਦੇਖਿਆ ਅਤੇ ਬਹੁਤ ਹੀ ਅੱਛਾ ਮਤਲਬ ਲੱਗਾ ਅਤੇ ਜਦੋਂ ਉਸ ਬੱਚੇ ਨੇ ਪਾਇਆ ਅਤੇ ਸਾਰੇ ਹੀ ਮਤਲਬ ਪੁੱਛਣ ਕਿ ਤੁਸੀਂ ਮਤਲਬ ਕਿੱਥੋਂ ਲਿਆ ਏ ਜਾਂ ਕਿੱਥੋਂ ਸਿਲਾਈ ਕਰਵਾਇਆ ਏ ਅਸੀਂ ਵੀ ਆਪਣੇ ਬੱਚਿਆਂ ਦਾ ਕਰਵਾਉਣਾ ਹੈ ਅਤੇ ਇਸ ਚੀਜ਼ ਦਾ ਜਦੋਂ ਕੋਈ ਆਪਣੀ ਚੀਜ਼ ਦੀ ਬਣੀ ਦੀ ਪ੍ਰਸ਼ੰਸਾ ਕਰਦਾ ਹੈ ਤਾਂ ਆਪਣੇ ਆਪ 'ਚ ਮੰਨ ਵਿੱਚ ਬਹੁਤ ਖੁਸ਼ੀ ਹੁੰਦੀ ਹੈ ਅਤੇ ਇਸ ਵਿੱਚ ਇੱਕ ਔਖਾ ਗੱਲ ਮੈਨੂੰ ਇਹ ਲੱਗੀ ਕਿ ਜਦੋਂ ਉਸਦਾ ਕੋਲਰ ਲਗਾਉਣਾ ਸੀਗਾ ਅਤੇ ਉਹਦੇ ਵਿੱਚ ਮੈਨੂੰ ਥੋੜ੍ਹਾ ਜਿਹਾ ਟੱਫ ਲੱਗਾ ਕਿ ਉਹ ਕੱਪੜਾ ਥੋੜ੍ਹਾ ਹਾਡ ਸੀਗਾ ਅਤੇ ਡੱਬਲ ਹੋ ਕੇ ਮਤਲਬ ਉਹ ਥੋੜ੍ਹੀ ਸਿਲਾਈ ਦੇ ਵਿੱਚ ਪ੍ਰੋਬਲਮ ਆ ਰਹੀ ਸੀ ਬਾਕੀ ਸਾਰਾ ਮਤਲਬ ਬਹੁਤ ਵਧੀਆ ਸਟਿਚ ਹੋਇਆ ਅਤੇ ਇਸਦੀ ਪ੍ਰਸ਼ੰਸਾ ਬਹੁਤ ਲੋਕਾਂ ਨੇ ਕੀਤੀ